ਪੰਜਾਬ 'ਚ ਕਾਰੋਬਾਰੀਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮੁਕਾਬਲਾ ਬੇਨੀਮੀਆ ਪ੍ਰਤਿਭਾ ਦੀ ਕਮੀ ਮੁਕਾਬਲੇ 'ਚ ਆਬਾਦੀ ਵੱਧ ਹੋਣ ਕਰਕੇ ਸਰਕਾਰ ਅਤੇ ਸਰਕਾਰ ਦੀ ਮਦਦ ਤਾਂ ਹੋਣ ਕਰਕੇ ਬਹੁਤ ਲੋਕਾਂ ਨੇ ਛੋਟੇ ਅਤੇ ਵੱਡੇ ਪੱਧਰ 'ਤੇ ਆਪਣੇ ਕਾਰੋਬਾਰ ਖੋਲੇ ਹੋਏ ਨੇ ਇਸ ਨਾਲ ਬਣਾਏ ਹੋਏ ਮਾਲ ਦੀ ਵਾਜਿਬ ਕੀਮਤ ਨਹੀਂ ਮਿਲਦੀ ਕੁਝ ਲੋਕ ਮਹਿੰਗੀਆਂ ਮਸ਼ੀਨਾਂ ਅਤੇ ਮਹਿੰਗੇ ਕਾਮੇ ਰੱਖੇ ਹੋਏ ਨੇ ਅਤੇ ਉਹ ਆਪਣੀ ਚੀਜ਼ ਦੀ ਵੱਧ ਕੀਮਤ ਮੰਗਦੇ ਨੇ ਪਰ ਕੁਝ ਲੋਕ ਸਸਤੀਆਂ ਮਸ਼ੀਨਾਂ 'ਤੇ ਸਸਤੇ ਕਾਮੇ ਅਤੇ ਘਟੀਆ ਸਮਾਨ ਬਣਾ ਕੇ ਉਹਨਾਂ ਦੀ ਵੀ ਕੀਮਤ ਘਟਾ ਦਿੰਦੇ ਨੇ ਪੰਜਾਬ ਸਰਕਾਰ ਦੇ ਕਾਰੋਬਾਰ ਲਈ ਚੰਗੇ ਨਿਯਮ ਨਾ ਹੋਣ ਕਰਕੇ ਕੁਝ ਲੋਕਾਂ ਨੂੰ ਮਾਲ ਦੇ ਕੇ ਪਰ ਪੈਸੇ ਨਹੀਂ ਮਿਲਦੇ

ਕਾਫੀ ਲੰਬੇ ਸਮੇਂ ਤੱਕ ਭੁਗਤਾਨ ਨਹੀਂ ਆਉਂਦਾ ਸਰਕਾਰਾਂ ਵੱਲੋਂ ਟੈਕਸ ਤਾਂ ਲਗਾਏ ਜਾਂਦੇ ਨੇ ਪਰ ਕਾਰੋਬਾਰੀਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਜਿਵੇਂ ਕਈ ਵਾਰੀ ਬਿਜਲੀ ਦੇ ਕੱਟ ਲੱਗਦੇ ਨੇ ਜਿਸ ਨਾਲ ਮਸ਼ੀਨਾਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਔਜ਼ਾਰ ਵੀ ਟੁੱਟਦੇ ਹਨ ਕਾਮਿਆਂ ਨੂੰ ਵੀ ਵਿਹਲਿਆਂ ਨੂੰ ਤਨਖਾਹ ਦੇਣੀ ਪੈਂਦੀ ਹੈ ਤਜ਼ਰਬੇਕਾਰ ਕਾਮੇ ਨਾ ਮਿਲਣ ਕਰਕੇ ਕਈ ਵਾਰ ਕੱਚੇ ਮਾਲ ਦਾ ਬਹੁਤ ਨੁਕਸਾਨ ਹੁੰਦਾ ਹੈ ਵਿਕਰੀ ਕਰਨ 'ਚ ਵੀ ਦੇਰੀ ਹੋ ਜਾਂਦੀ ਹੈ ਅਤੇ ਕਈ ਵਾਰ ਬਹੁਤ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈਂਦਾ